ਪੰਜਾਬੀ ਭਾਸ਼ਾ ਸਾਨੂੰ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦੀ ਹੈ ਔਰ ਇਹ ਸਾਡੀ ਸਿੱਖਿਆ ਵਿੱਚ ਇਹ ਭੂਮਿਕਾ ਨਿਭਾਉਂਦੀ ਹੈ ਕਿ ਸਾਡੇ ਕਿ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਬੰਦੇ ਹੋ ਕੇ ਵੀ ਅਸੀਂ ਇੱਕ ਹੀ ਭਾਸ਼ਾ ਨਾਲ ਜੁੜੇ ਹਾਂ ਜੋ ਕਿ ਹੈ ਸਾਡੀ ਪੰਜਾਬੀ ਜੋ ਸਾਡੀ ਲਿਖਿਤ ਪੰਜਾਬੀ ਸਾਡੀ ਕਿਤਾਬਾਂ ਵਿੱਚ ਆਉਂਦੀ ਹੈ ਉਸ ਰਾਹੀਂ ਅਪ ਅਸੀਂ ਅਪ ਆਪਣੇ ਬਾਕੀ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ ਉਹਨਾਂ ਦੇ ਦੁੱਖ ਤਕਲੀਫ ਸਮਝ ਕੇ ਉਹਨਾਂ ਦੇ ਦੁੱਖਾਂ ਨੂੰ ਸਾਂਝਾ ਕਰ ਸਕਦੇ ਹਾਂ ਔਰ ਇੱਕ ਦੂਜੇ ਦੇ ਮਨ ਅਤੇ ਸਥਿਤੀ ਨੂੰ ਵੀ ਸਮਝ ਸਕਦੇ ਹਾਂ ਇਸ ਕਰਕੇ ਪੰਜਾਬੀ ਭਾਸ਼ਾ ਜੋ ਕਿ ਸਾਡੇ ਲਿਖਤੀ ਕਿਤਾਬਾਂ ਵਿੱਚ ਆਉਂਦੀ ਹੈ ਉਹ ਸਾਨੂੰ ਸਾਡੇ ਸਾਰੇ ਜ਼ਿਲ੍ਹਿਆਂ ਨੂੰ ਇਕੱਠਾ ਕਰਕੇ ਰੱਖਦੀ ਹੈ ਜਿਸ ਨਾਲ ਆਪਾਂ ਇੱਕ ਦੂਜਿਆਂ ਨੂੰ ਸਮਝ ਸਕਦੇ ਹਾਂ ਔਰ ਨਾਲ ਦੀ ਨਾਲ ਪੰਜਾਬੀ ਭਾਸ਼ਾ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਹ ਸਾਡੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਰ ਦਿੱਤੀ ਗਈ ਹੈ ਕਿ ਸਾਡੇ ਪੰਜਾਬ ਦੇ ਜਿੰਨੇ ਵੀ ਸਕੂਲ ਹਨ ਉਹ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਤਾਂ ਕਿ ਪੰਜਾਬ ਦੇ ਬੱਚੇ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ ਅਤੇ ਉਸ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਰੱਖਣ ਉਹ ਆਪਣੇ ਲੋ ਪੰਜਾਬੀ ਸੱਭਿਆਚਾਰ ਨਾਲ ਜੁੜਨ ਉਹਨਾਂ ਨੂੰ ਆਪਣੇ ਪੰਜਾਬ ਦੇ ਹਰ ਇੱਕ ਸੱਭਿਆਚਾਰ ਦਾ ਪਤਾ ਚੱਲੇ ਤਾਂ ਕਿ ਉਹ ਆਪਣੇ ਪੰਜਾਬੀ ਲੋਕ ਨਾਚ ਪੰਜਾਬੀ ਸੱਭਿਆਚਾਰ ਨੂੰ ਬਚਾ ਸਕਣ ਅਤੇ ਇੱਕ ਦੂਜੇ ਨਾਲ ਮਿਲ ਵਰਤ ਕੇ ਰਹਿਣ ਔਰ ਆਖਿਰ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਸਾਡੀ ਪੰਜਾਬੀ ਭਾਸ਼ਾ ਹੈ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਔਰ ਅਸੀਂ ਉਸ ਨੂੰ ਅੱਗੇ ਵਧਾਵਾਂਗੇ ਅਤੇ ਸਾਰੇ ਹੀ ਲੋਕ ਜੋ ਕਿ ਸਾਡੇ ਪੰਜਾਬ ਦੇ ਵਾਸੀ ਹਾਂ ਉਹ ਪੰਜਾਬੀ ਭਾਸ਼ਾ ਨੂੰ ਪੂਰੀ ਪੂਰੀ ਮਹੱਤਤਾ ਦੇਣਗੇ